ਸੁਣ ਰਹੇ ਓ ਤੁਸੀਂ ਹਫਤੇ ਦਾ ਅੰਤ ਘਰ ਵਿੱਚ ਬਿਤਾ ਰਹੇ ਹੋ ਅਤੇ ਇੱਕ ਨਵੀਂ ਲੜੀ ਦੇਖਣਾ ਚਾਹੁੰਦੇ ਹੋ ਪਰ ਤੁਸੀਂ ਵਿਕਲਪਾਂ ਤੋਂ ਪ੍ਰਭਾਵਿਤ ਹੋ ਐਕਸ਼ਨ ਹਫਤੇ ਦੇ ਅੰਤ ਵਿੱਚ ਵਿੰਜ ਚ ਦੇਖਣ ਦੇ ਸੈਸ਼ਨ ਲਈ ਆਪਣੇ ਉਤਸਾਹ ਨੂੰ ਪ੍ਰਗਟ ਕਰੋ ਅਤੇ ਨਵੀਂ ਲੜੀ ਦੀ ਖੋਜ ਵਿੱਚ ਆਪਣੀ ਦਿਲਚਸਪੀ ਦਾ ਜ਼ਿਕਰ ਕਰੋ ਫੈਸਲੇ ਲੈਣ ਦੇ ਨਾਲ ਆਪਣੇ ਸੰਘਰਸ਼ ਨੂੰ ਸਾਂਝਾ ਕਰੋ ਅਤੇ ਆਪਣੀਆਂ ਚੋਣਾਂ ਨੂੰ ਸੀਮਤ ਕਰਨ ਲਈ ਸਿਫਾਰਸ਼ਾਂ ਮੰਗੋ